ਸਿਲਾਈ ਕਢਾਈ ਮੇਰਾ ਕਿੱਤਾ ਹੈ ਜਦੋਂ ਮੈਨੂੰ ਮੁਸ਼ਕਿਲ ਆਉਂਦੀ ਹੈ ਸਿਲਾਈ ਕਢਾਈ ਕੁ ਕੁਛ ਸਮਝ ਨਹੀਂ ਆਉਂਦੀ ਤਾਂ ਮੈਂ ਯੂਟਿਊਬ 'ਤੇ ਦੇਖ ਲੈਂਦੀ ਹਾਂ ਜੇ ਮੈਂ ਮੈਨੂੰ ਯੂਟਿਊਬ 'ਤੇ ਵੀ ਸਮਝ ਨਾ ਆਉਂਦੀ ਤਾਂ ਮੈਂ ਫੋਨ ਕਰਕੇ ਰਿਸ਼ਤੇਦਾਰ ਤੋਂ ਕਿਸੇ ਤੋਂ ਪੁੱਛ ਲੈਂਦੀ ਹਾਂ